ਸਰਕਾਰੀ ਸਕੀਮਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਯੋਜਨਾਵਾਂ ਚੱਲ ਰਹੀਆਂ ਨੇ ਜਿੱਦਾਂ ਕਿ ਹੁਣ ਨਿਊ ਯੋਜਨਾ ਸ਼ੁਰੂ ਕੀਤੀ ਆ ਵਿਸ਼ਵਕਰਮਾ ਸੈਂਟਰ ਗੌਰਮੈਂਟ ਦੁਆਰਾ ਸ਼ੁਰੂ ਕੀਤੀ ਗਈ ਸਕੀਮ ਹੈ ਇਹ ਇਹਦੇ ਵਿੱਚ ਜੋ ਹੱਥਘੜ ਮਜ਼ਦੂਰ ਆਪਣੇ ਮਿਸਤਰੀ ਨੇ ਜੋ ਹੱਥੀਂ ਕੰਮ ਕਰਦੇ ਨੇ ਜਿੱਦਾਂ ਕਿ ਲੁਹਾਰ ਹੋ ਗਿਆ ਆਪਣਾ ਵੈਲਡਰ ਹੋ ਗਿਆ ਅਤੇ ਉਸ ਤੋਂ ਇਲਾਵਾ ਲੱਕੜਾਂ ਦਾ ਕੰਮ ਕਰਨ ਵਾਲਾ ਮਿਸਤਰੀ ਹੋ ਗਏ ਇਹਨਾਂ ਨੂੰ ਇੱਕ ਲੱਖ ਤੱਕ ਦਾ ਲੋਨ ਪ੍ਰੋਵਾਈਡ ਕਰਵਾਇਆ ਜਾਂਦਾ ਗਾ ਜੋ ਕਿ ਗੌਰਮੈਂਟ ਸ ਗੌਰਮੈਂਟ ਔਫ ਇੰਡੀਆ ਦੀ ਬਹੁਤ ਹੀ ਵਧੀਆ ਪਹਿਲ ਹੈ ਕਿਉਂਕਿ ਅੱਜ ਕੀ ਹੁੰਦਾ ਹੈ ਕੰਮ ਹਰ ਬੰਦਾ ਸਿੱਖ ਲੈਂਦਾ ਹੈ ਪਰ ਉਹ ਉਸਨੂੰ ਅੱਗੇ ਵਧਣ ਵਾਸਤੇ ਜਾਂ ਕੰਮ ਨੂੰ ਫਿਕਸ ਕਰਨ ਵਾਸਤੇ ਜਦ ਜਿੱਦਾਂ ਆਪਾਂ ਨੋਰਮਲ ਸੌਖੀ ਭਾਸ਼ਾ 'ਚ ਕਹਿ ਦਈਏ ਵੀ ਉਹਨੂੰ ਆਪਦਾ ਕਿੱਤਾ ਸ਼ੁਰੂ ਕਰਨ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੁੰਦੇ ਅਤੇ ਗੌਰਮੈਂਟ ਦੀ ਇਹ ਬਹੁਤ ਹੀ ਅਨੌਖੀ ਪਹਿਲਾ ਆ ਵੀ ਉਹਨਾਂ ਨੂੰ ਕੰਮ ਸ਼ੁਰੂ ਕਰਨ ਵਾਸਤੇ ਆਪਦੇ ਸੰਦ ਬਣਾਉਣ ਵਾਸਤੇ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਵਾਇਆ ਜਾਂਦਾ ਗਾ ਅਤੇ ਇਹ ਲੋਨ ਦੇ ਵਿੱਚ ਕੁਝ ਪਰਸੈਂਟ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜੇਕਰ ਕੋਈ ਬੰਦਾ ਇਸ ਲੋਨ ਨੂੰ ਸਹੀ ਭਰਦਾ ਗਾ ਤਾਂ ਉਸਨੂੰ ਦੂਸਰੇ ਜਾਂ ਤੀਸਰੇ ਸਾਲ ਲੱਖ ਤੋਂ ਪਲੱਸ ਲੋਨ ਦਿੱਤਾ ਜਾਂਦਾ ਗਾ ਦੂਜੀ ਸਭ ਤੋਂ ਜੋ ਵੱਡੀ ਯੋਜਨਾ ਹੈ ਜੋ ਦੋ ਹਜ਼ਾਰ ਪੰਦਰ੍ਹਾਂ ਤੋਂ ਚਲਦੀ ਆ ਰਹੀ ਹੈ ਉਹ ਸਕੀਮ ਆ ਮਨਰੇਗਾ ਜਿਹਦੇ ਵਿੱਚ ਇੱਕ ਵਿਅਕਤੀ ਨੂੰ ਘੱਟੋ ਘੱਟ ਸੌ ਦਿਨ ਦਾ ਵਰਕ ਦਿੱਤਾ ਜਾਂਦਾ ਗਾ ਉਹਦੇ ਲਈ ਉਹਨੂੰ ਘੱਟੋ ਘੱਟ ਜੇਕਰ ਕਿਸੇ ਵਿਅਕਤੀ ਦਾ ਨਰੇਗਾ ਦਾ ਕਾਰਡ ਬਣਿਆ ਹੈਗਾ ਹੈਗਾ ਉਹਦੀ ਕੁਛ ਸ਼ਰਤਾਂ ਨੇ ਜਿੱਦਾਂ ਕਿ ਉਹਦੇ ਵਿੱਚ ਘੱਟੋ ਘੱਟ ਉਮਰ ਅਠਾਰ੍ਹਾਂ ਸਾਲ ਹੋਣੀ ਚਾਹੀਦੀ ਹੈਗੀ ਅਤੇ ਕਾਰਡ ਬਣਨ ਤੋਂ ਬਾਅਦ ਉਹਨੂੰ ਇੱਕ ਸਾਲ ਦੇ ਵਿੱਚ ਘੱਟੋ ਘੱਟ ਸੌ ਦਿਨ ਦਾ ਕੰਮ ਜੋ ਗੌਰਮੈਂਟ ਸਰਕਾਰ ਆ ਗੌਰਮੈਂਟ ਔਫ ਇੰਡੀਆ ਉਹਦੇ ਦੁਆਰਾ ਦਿੱਤਾ ਹੀ ਜਾਂਦਾ ਗਾ ਉਸ ਤੋਂ ਬਾਅਦ ਜੋ ਅੱਜ ਕੱਲ੍ਹ ਦੀ ਸਕੀਮ ਹੈ ਉਹ ਹੈ ਪੀ ਐਮ ਜੇ ਕੇ ਵਾਈ ਜਦੋਂ ਪ੍ਰਧਾਨ ਮੰਤਰੀ ਜਨ ਕੁਸ਼ਲ ਯੋਜਨਾ ਹੈ ਜਿਹਦੇ ਅਧਾਰ 'ਤੇ ਆਵਾਸ ਯੋਜਨਾ ਇਹ ਤਾਂ ਜਿਹਦੇ ਵਿੱਚ ਆਵਾਸ ਯੋਜਨਾ ਵੀ ਆ ਜਾਂਦੀ ਹੈ ਸਕਿੱਲ ਇੰਡੀਆ ਵੀ ਆ ਜਾਂਦੀ ਹੈਗੀ ਹੈ ਠੀਕ ਹੈ ਜਿਹਦੇ ਵਿੱਚ ਜੋ ਮੱਧਮ ਮੱਧਮ ਜਾਂ ਜਿਹਨੂੰ ਆਪਾਂ ਕਹਿ ਲਈਏ ਵੀ ਕਾਸਟ ਦੇ ਜਾਂ ਗਰੀਬੀ ਤੋਂ ਰੇਖਾ ਤੋਂ ਨੀਚੇ ਦੇ ਬੰਦੇ ਨੇ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਵਾਇਆ ਜਾਂਦਾ ਗਾ ਘਰ ਵਾਸਤੇ ਪੈਸੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦਾ ਜੋ ਗਰੀਬੀ ਸਤਰ ਆ ਉਹ ਉੱਚਾ ਚੱਕਣ ਵਾਸਤੇ ਗੌਰਮੈਂਟ ਸਰਕਾਰ ਦੀ ਇਹ ਵੀ ਬਹੁਤ ਵੱਡੀ ਇੱਕ ਅਨੋਖੀ ਪਹਿਲ ਹੈ ਉਸ ਤੋਂ ਬਾਅਦ ਗੱਲ ਕਰੀਏ ਸਕੀਮ ਦੀ ਤਾਂ ਪੰਜਾਬ ਸਕੋਲਰਸ਼ਿਪ ਸਕੀਮ ਸਰਕਾਰ ਦੀ ਜੋ ਕਿ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਸਕੋਲਰਸ਼ਿਪ ਪ੍ਰੋਵਾਈਡ ਕਰਵਾਉਂਦੀ ਹੈ ਉਸ ਤੋਂ ਬਾਅਦ ਜੋ ਅਜੋਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਸਕੂਲ ਅੋਫ ਐਮੀਨੈਂਸ ਜਿਹਨਾਂ ਦੇ ਅਧਾਰ 'ਤੇ ਜੋ ਗਰੀਬੀ ਰੇਖਾ ਤੋਂ ਨੀਚੇ ਬੱਚੇ ਨੇ ਜੋ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਨਹੀਂ ਸਕ ਮਤਲਬ ਕਿ ਜੋ ਅੰਗਰੇ ਇੰਗਲਿਸ਼ ਮੀਡੀਅਮ ਨਹੀਂ ਪ੍ਰੋਵਾਈਡ ਕਰਵਾ ਸਕਦੇ ਉਹਨਾਂ ਨੂੰ ਇੰਗਲਿਸ਼ ਮੀਡੀਅਮ ਦੀਆਂ ਜੋ ਫੈਸਿਲਿਟੀਆਂ ਹੁੰਦੀਆਂ ਨੇ ਉਹਨਾਂ ਨੂੰ ਸਿਖਾਉਣ ਵਾਸਤੇ ਹਰ ਇੱਕ ਚੀਜ਼ ਉਹ ਪ੍ਰਦਾਨ ਕਰਵਾਈਆਂ ਜਾਂਦੀਆਂ ਹੈ